ਹਾਂਜੀ ਬ ਅਸੀਂ ਆਪਣੇ ਬਗੀਚੇ ਵਿੱਚ ਬਹੁਤ ਸਾਰੇ ਪੌਦੇ ਲਗਾਏ ਹੋਏ ਆ ਜਿਵੇਂ ਕਿ ਅਮਰੂਦ ਹੋ ਗਿਆ ਸੰਤਰਾ ਅਤੇ ਸੇਬ ਦਾ ਪੌਦਾ ਵੀ ਲਗਾਇਆ ਅਸੀਂ ਚੀਕੂ ਦਾ ਸੇਬ ਵੈਸੇ ਤਾਂ ਠੰਡੇ ਇਲਾਕੇ ਵਿੱਚ ਹੁੰਦਾ ਹੈ ਪਰ ਅਸੀਂ ਲਗਾ ਕੇ ਦੇਖਿਆ ਸੀ ਕਿ ਦੇਖਦੇ ਹਾਂ ਹੁੰਦਾ ਜਾਂ ਨਹੀਂ ਹੁੰਦਾ ਪਰ ਤਿੰਨ ਚਾਰ ਸਾਲ ਬਾਅਦ ਉਸਨੂੰ ਫਲ਼ ਪੈਣਾ ਸ਼ੁਰੂ ਹੋਇਆ ਅਤੇ ਠੀਕ ਲੱਗਿਆ ਸਾਨੂੰ ਵਧੀਆ ਫਲ਼ ਲੱਗੇ ਆ ਅਤੇ ਚੀਕੂ ਨੂੰ ਵੀ ਫਲ਼ ਲੱਗੇ ਆ ਅੰਬ ਦਾ ਪੌਦਾ ਵੀ ਲਗਾਇਆ ਹੋਇਆ ਉਸ 'ਤੇ ਵੀ ਵਧੀਆ ਫਲ਼ ਲੱਗ ਰਹੇ ਆ ਅਤੇ ਵਧੀਆ ਲੱਗਦਾ ਸਾਨੂੰ ਅੱਛੀ ਤਰ੍ਹਾਂ ਉਨ੍ਹਾਂ ਦੀ ਉਹ ਕਰੀਏ ਅਸੀਂ ਵਧੀਆ ਉਪਜਾਊ ਪੌਦੇ ਆ ਸਾਰੇ